ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਠਾਨਕੋਟ ਤੋਂ ਹਰਜੀਤ ਕੌਰ ਬੋਲ ਰਹੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਕਾਫੀ ਅਜਾਇਬ ਘਰ ਹਨ ਜਿਹਨਾਂ ਵਿੱਚੋਂ ਅੰਮ੍ਰਿਤਸਰ ਲੁਧਿਆਣਾ ਅਜਾਇਬ ਘਰ ਹਨ ਉਹਨਾਂ ਵਿੱਚੋਂ ਸਭ ਤੋਂ ਵ ਮਸ਼ਹੂਰ ਅਤੇ ਦੇਖਣ 'ਚ ਵਧੀਆ ਲੱਗਦਾ ਅੰਮ੍ਰਿਤਸਰ ਅਜ ਅੰਮ੍ਰਿਤਸਰ ਦਾ ਅਜਾਇਬ ਘਰ ਹੈ ਜੋ ਕਿ ਸਾਨੂੰ ਸਾਡੀ ਧਾਰਮਿਕ ਆਸਥਾ ਨੂੰ ਨ ਬਹੁਤ ਵਧੀਆ ਲੱਗਦਾ ਹੈ ਜਿਸ ਤਰ੍ਹਾਂ ਅਸੀਂ ਜਾਂਦੇ ਹਾਂ ਅਤੇ ਅਸੀਂ ਜਾਂਦਿਆਂ ਹੀ ਅਸੀਂ ਪ੍ਰਦਰਸ਼ਨੀ ਦੇ ਅੰਦਰ ਜਾਂਦੇ ਹਾਂ ਅਤੇ ਦੇਖਦੇ ਹਾਂ ਕਿ ਉਹਦੇ ਵਿੱਚ ਸਾਡੇ ਸ਼ਹੀਦਾਂ ਦੀ ਯਾਦਗਾਰ ਨੂੰ ਤਾਜ਼ਾ ਕਰਦੇ ਹਨ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਮਾਤਾ ਸੁੰਦਰੀ ਜੀ ਇਸ ਤਰ੍ਹਾਂ ਦੇ ਸਾਰੇ ਮਤਲਬ ਕਿ ਜੋ ਵੀ ਸਾਡੇ ਧਰਮ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਨਾਲ ਅਸੀਂ ਰਿਲੇਟਡ ਚੀਜ਼ਾਂ ਦੇਖਦੇ ਹਾਂ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਆ ਉਹਨਾਂ ਦੀਆਂ ਉਹਨਾਂ ਦੇ ਸ਼ਹੀ ਸ਼ਹੀਦਾਂ ਦੇ ਤਸਵੀਰਾਂ ਲਗਾਈਆਂ ਹੋਈਆਂ ਹਨ ਜੋ ਕਿ ਸਾਡੇ ਮਨ ਨੂੰ ਦੇਖਣ ਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਅਤੇ ਦੇਖਣ ਨੂੰ ਸਾਡੀ ਮਤਲਬ ਕਿ ਆਸਥਾ ਬਣਦੀ ਹੈ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਵੀ ਦੱਸਿਆ ਗਿਆ ਹੈ ਉਹਨਾਂ ਦੀ ਜਿਸ ਤਰ੍ਹਾਂ ਸ਼ਹੀਦੀ ਹੋਈ ਉਹ ਉਹਨਾਂ ਬਾਰੇ ਵੀ ਦੱਸਿਆ ਗਿਆ ਜਿਸ ਤਰ੍ਹਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਜੰਗਾਂ ਲੜੀਆਂ ਉਹਨਾਂ ਦਾ ਵੀ ਜੋ ਉਹਨਾਂ ਦੀਆਂ ਸ ਉਹਨਾਂ ਦਾ ਸਾਜੋ ਸਮਾਨ ਜੋ ਵੀ ਜੰਗਾਂ 'ਚ ਵਰਤਦੇ ਜੋ ਉੱਥੇ ਜੋ ਵੀ ਪਿਆ ਹੋਇਆ ਸਭ ਅ ਸਾਨੂੰ ਦੇਖਣ ਨੂੰ ਮਿਲਦਾ ਹੈ